ਵਿਗਿਆਨ ਅਤੇ ਤਕਨੋਲਜੀ ਬਾਰੇ ਬਹੁਤ ਕੁਝ ਜੇ ਹੁਣ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਕਿ ਅਸੀਂ ਦੇਖਦੇ ਹਾਂ ਇਸਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਘਰ ਬੈਠੇ ਅਸੀਂ ਟਿਕਟਾਂ ਬੁੱਕ ਕਰ ਸਕਦੇ ਹਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਗੱਡੀ ਬੁੱਕ ਕਰ ਸਕਦੇ ਹਾਂ ਹੋਰ ਬਹੁਤ ਜ਼ਿਆਦਾ ਦੇਖਦੇ ਹਾਂ ਕਿ ਵਿਗਿਆਨ ਨੇ ਸਾਨੂੰ ਅਲੱਗ ਅਲੱਗ ਦੇਸ਼ਾਂ ਨਾਲ ਜੋੜ ਦਿੱਤਾ ਹੈ ਜਿਸ ਦੇ ਨਾਲ ਕਿ ਟੈਕਨੋਲਜੀ ਅਤੇ ਵਿਗਿਆਨ ਵਿੱਚ ਦੋਨਾਂ ਵਿੱਚ ਬਹੁਤ ਜ਼ਿਆਦਾ ਵੱਖਰਤਾ ਦੇਖਣ ਨੂੰ ਮਿਲੀ ਹੈ ਜੋ ਕਿ ਉੱਭਰ ਕੇ ਸਾਹਮਣੇ ਆਈ ਹੈ ਜੋ ਕਿ ਸਾਡੇ ਲਈ ਬਹੁਤ ਮਾਣ ਅਤੇ ਵਧੀਆ ਵਾਲੀ ਗੱਲ ਹੈ